ਹੈਲੋ ਜੀ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਪੰਜਾਬ ਦਾ ਰਹਿਣ ਵਾਲਾ ਅਤੇ ਮੈਂ ਇੱਕ ਮਤਲਬ ਕਿ ਰਿਸਰਚ ਕਰ ਰਿਹਾ ਇਕਨੋਮੀ 'ਤੇ ਅਤੇ ਮੇਰੀ ਇੱਕ ਸਿੰਘ ਨਾਲ ਗੱਲ ਹੋ ਰਹੀ ਹੈ ਮੈਂ ਬਈ ਆਪਣੇ ਰਿਸਰਚਿੰਗ ਦੇ ਮਤਲਬ ਕਿ ਡਾਕੂਮੈਂਟਰੀ ਲਿਖ ਰਿਹਾ ਅਤੇ ਮੈਂ ਪੁੱਛਣਾ ਕਿ ਇਕਨੋਮੀ ਮਤਲਬ ਕਿੱਦਾਂ ਇਫੈਕਟ ਕਰ ਰਹੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਅਟ੍ਰੈਕਟ ਹੁੰਦੇ ਆ ਜੀ ਜੀ ਜੀ

ਮੇਨ ਜੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜ਼ਿਆਦਾ ਕਰ ਕਿਸਾਨ ਦਾ ਬਹੁਤ ਵੱਡਾ ਰੋਲ ਹੈ ਸਾਡੀ ਇਹ 'ਚ ਇਕਨੋਮੀ 'ਚ ਅਤੇ ਜਿੱਦਾਂ ਇਹ ਵੇਰੀਸ ਇੰਡਸਟਰੀਸ ਇੱਦਾਂ ਹੈਗੀਆਂ ਅਤੇ ਇਹ ਵੀ ਕਾਫੀ ਪ੍ਰੋਫਿਟ ਹੋ ਰਿਹਾ ਇਹਨਾਂ ਨੂੰ ਜੀ ਜੀ ਜਿੱਦਾਂ ਕਿ ਮਤਲਬ ਕਿ ਕੋਟਨ ਵਗੈਰਾ ਹੋ ਗਿਆ ਜੂਟ ਹੋ ਗਿਆ ਜੀ ਥੈਂਕ ਯੂ ਜੀ ਆਪਣਾ ਪ੍ਰੀਸ਼ਅਸ ਟਾਈਮ ਦੇਣ ਲਈ ਮੈਨੂੰ ਠੀਕ ਹੈ ਜੀ ਧੰਨਵਾਦ ਠੀਕ